ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਰਾਜਵੀਰ ਗੱਲ ਕਰ ਰਿਹਾ ਹਾਂ ਮੈਂ ਹਾਲਾਂ ਹੀ ਤੁਹਾਡੀ ਓਲਾ ਦੀ ਕੈਬ ਬੁੱਕ ਕੀਤੀ ਸੀ ਜੋ ਕਿ ਐਕਸੈਂਟ ਸੀ ਅਤੇ ਮੈਂ ਉਸ ਨਾਲ ਦਿੱਲੀ ਜਾਣਾ ਸੀ ਮੇਰੀ ਇੰਟਰਵਿਊ ਸੀ ਜੋਬ ਲਈ ਅਤੇ ਉਹ ਇੰਟਰਵਿਊ ਕੁਝ ਕਾਰਨਾਂ ਕਾਰਨ ਕੈਂਸਲ ਹੋ ਗਈ ਅਤੇ ਉਸਦੀ ਡੇਟ ਅਗਾਊਂ ਸ਼ਿਫਟ ਹੋ ਚੁੱਕੀ ਹੈ ਭਾਅ ਜੀ ਤੁਹਾਡੀ ਇਹ ਕੈਬ ਇੱਥੋਂ ਪਟਿਆਲੇ ਤੋਂ ਚੱਲਣੀ ਸੀ ਅਤੇ ਮੈਨੂੰ ਪਟਿਆਲੇ ਵਿੱਚ ਪ੍ਰੀਤ ਨਗਰ ਵਿੱਚੋਂ ਪਿੱਕ ਕਰਕੇ ਮੈਨੂੰ ਦਿੱਲੀ ਏਅਰਪੋਰਟ ਲੈ ਕੇ ਜਾਣ ਲਈ ਸੀ ਇਹ ਕੈਬ ਐਕਸੈਂਟ ਸੀ ਅਤੇ ਇਸਦਾ ਨੰਬਰ ਸੀ ਪੀ ਬੀ ਜ਼ੀਰੋ ਇੱਕ ਸੀ ਅਠਾਨਵੇਂ ਚੁਹੱਤਰ ਅਤੇ ਇਹ ਕੈਬ ਤੁਸੀਂ ਬੁੱਕ ਕਰਵਾ ਕੇ ਦਿੱਤੀ ਸੀ ਅਤੇ ਇਸ ਦੇ ਸਾਰੇ ਦੇ ਸਾਰੇ ਪੇਮੈਂਟ ਵਗੈਰਾ ਪੂਰੀ ਹੋ ਹੋਣ ਵਾਲੀ ਹੀ ਸੀ ਇਸ ਦਾ ਐਡਵਾਂਸ ਮੈਂ ਤੁਹਾਨੂੰ ਇੱਕ ਹਜ਼ਾਰ ਰੁਪਏ ਪੇ ਕਰ ਚੁੱਕਿਆ ਸੀ ਅਤੇ ਹੁਣ ਵੀ ਦਸ ਮਿੰਟ ਪਹਿਲਾਂ ਮੈਂ ਤੁਹਾਨੂੰ ਇਸ ਦੇ ਪੇਮੈਂਟ ਪੂਰੀ ਕਰਕੇ ਹਟਿਆ ਸੀ ਜੋ ਕਿ ਸੱਤ ਹਜ਼ਾਰ ਰੁਪਇਆ ਸੀ ਜਿਸ ਵਿੱਚ ਕਿ ਤੇਲ ਦਾ ਖਰਚਾ ਡਰਾਈਵਰ ਦਾ ਖਾਣ ਪੀਣ ਦਾ ਖਰਚਾ ਸਭ ਇੰਕਲੂਡਡ ਸੀ ਜਿੱਦਾਂ ਕਿ ਆਪਣੀ ਗੱਲ ਹੋਈ ਸੀ ਪਰ ਭਾਅ ਜੀ ਹੁਣ ਜਿੱਦਾਂ ਕਿ ਮੇਰੇ ਜਾਣ ਦਾ ਪ੍ਰੋਗਰਾਮ ਹੀ ਕੈਂਸਲ ਹੋ ਚੁੱਕਾ ਹੈ ਇਸ ਕਾਰਨ ਮੈਂ ਹੁਣ ਚਾਹੁੰਦਾ ਹਾਂ ਕਿ ਤੁਸੀਂ ਇਹ ਕੈਬ ਮੇਰੀ ਕੈਂਸਲ ਕਰ ਦੇਵੋ ਅਤੇ ਡਰਾਈਵਰ ਨੂੰ ਵੀ ਕਹੋ ਕਿ ਉਹ ਆਰਾਮ ਕਰ ਸਕਦੇ ਹਨ ਜਾਂ ਕੋਈ ਹੋਰ ਔਡਰ ਬੁੱਕ ਕਰ ਸਕਦੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰ ਆਪ ਜੀ ਨੂੰ ਇੱਕ ਹੋਰ ਬੇਨਤੀ ਹੈ ਕਿਰਪਾ ਕਰਕੇ ਇਹ ਮੇਰੇ ਵੋਲਟ ਵਿੱਚ ਮੈਨੂੰ ਕੈਸ਼ਬੈਕ ਵਾਪਸ ਕਰ ਦਿਓ ਕਿਉਂਕਿ ਮੈਂ ਕਿਤੇ ਗਿਆ ਵੀ ਨਹੀਂ ਅਤੇ ਮੈਂ ਤੁਹਾਨੂੰ ਕੈਬ ਦੇ ਚੱਲਣ ਦੇ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਇਸ ਕਰਕੇ ਡਰਾਈਵਰ ਦਾ ਤੇਲ ਵੀ ਨਹੀਂ ਲੱਗਾ ਹੋਵੇਗਾ ਤਾਂ ਇਸ ਕਰਕੇ ਤਾਂ ਜੋ ਮੈਨੂੰ ਵੀ ਮੇਰੇ ਪੈਸੇ ਵਾਪਸ ਮਿਲ ਜਾਣ ਮੈਂ ਵੀ ਇੱਕ ਸਟੂਡੈਂਟ ਹੀ ਹਾਂ ਅਤੇ ਮੇਰੇ ਕੋਲ ਵੀ ਆਪਣੀ ਕਮਾਈ ਜੋਗੇ ਪੈਸੇ ਇੰਟਰਨਸ਼ਿਪ ਲਗਾ ਕੇ ਹੀ ਆਉਂਦੇ ਹਨ ਇਸ ਲਈ ਕਿਰਪਾ ਕਰਕੇ ਮੇਰੇ ਹਾਲਾਤਾਂ ਨੂੰ ਸਮਝੋ ਅਤੇ ਮੈਨੂੰ ਪੈਸਿਆਂ ਦਾ ਕੈਸ਼ਬੈਕ ਵਾਪਸ ਕਰ ਦਿਓ ਸਿੱਧਾ ਮੇਰੇ ਔਲਾ ਕੈਬ ਵ ਵਾਲਿਟ ਵਿੱਚ ਸਿੱਧਾ ਹੀ ਮੇਰੇ ਖਾਤੇ ਵਿੱਚ ਟ੍ਰਾਂਸਫਰ ਕਰ ਦਿਓ ਇਸ ਲਈ ਤਾਂ ਜੋ ਆਪਣਾ ਅੱਗੇ ਲਈ ਭਰੋਸਾ ਬਣਿਆ ਰਹੇ ਅਤੇ ਮੈਂ ਕੋਈ ਵੀ ਕੰਮ ਲਈ ਤੁਹਾਡੇ ਕੋਲ ਹੀ ਆਉਂਦਾ ਰਹਾਂ ਪਹਿਲਾਂ ਵੀ ਮੈਂ ਕੋਈ ਹੋਰ ਐਪ ਨਹੀਂ ਦੇਖੀ ਸਿਰਫ ਤੁਹਾਡੀ ਓਲਾ ਕੈਬਸ 'ਤੇ ਹੀ ਭਰੋਸਾ ਕੀਤਾ ਅਤੇ ਇਸ 'ਤੇ ਭਰੋਸਾ ਰੱਖ ਕੇ ਹੀ ਮੈਂ ਸਾਰੇ ਕੰਮ ਸਾਰੀਆਂ ਟੈਕਸੀਆਂ ਆਪਣੇ ਦੋਸਤਾਂ ਦੇ ਵੀ ਔਡਰ ਬੁੱਕ ਕੀਤੇ ਹਨ ਟੈਕਸੀਆਂ ਵਾਸਤੇ ਪਰ ਹੁਣ ਇਸ ਟਾਈਮ 'ਤੇ ਮੇਰੀ ਮਜ਼ਬੂਰੀ ਹੈ ਤੁਸੀਂ ਕਿਰਪਾ ਕਰਨਾ ਮੇਰੀ ਮਜ਼ਬੂਰੀ ਸਮਝਿਓ ਅਤੇ ਉਸ ਮਜ਼ਬੂਰੀ ਨੂੰ ਸਮਝ ਕੇ ਮੈਨੂੰ ਪੈਸੇ ਵਾਪਸ ਪਾ ਦਿਓ ਤਾਂ ਜੋ ਮੈਂ ਅੱਗੇ ਤੋਂ ਵੀ ਤੁਹਾਡੇ 'ਤੇ ਭਰੋਸਾ ਬਣਾ ਕੇ ਤੁਹਾਡੇ ਤੋਂ ਹੀ ਦੁਬਾਰਾ ਕੈਬ ਔਡਰ ਕਰ ਸਕਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ